ਭਾਅ ਜੀ ਸਤਿ ਸ਼੍ਰੀ ਅਕਾਲ ਜੀ ਗਗਨ ਮੋਬਾਈਲ ਸ਼ੋਪ ਤੋਂ ਗੱਲ ਕਰ ਰਹੇ ਓ ਜੀ ਅਸੀਂ ਇੱਕ ਫੋਨ ਔਡਰ ਕੀਤਾ ਸੀਗਾ ਜਿਹਦੀ ਡਿਲੀਵਰੀ ਅੱਜ ਹੋਈ ਹੈ ਜੀ ਜਦੋਂ ਅਸੀਂ ਖੋਲ੍ਹ ਕੇ ਦੇਖਿਆ ਜੀ ਫੋਨ ਦਾ ਬੋਕਸ ਪਹਿਲਾਂ ਤਾਂ ਫੋਨ ਦੇ ਬੋਕਸ ਤੋਂ ਹੀ ਸਾਨੂੰ ਲੱਗਿਆ ਕਿ ਜਿਦਾਂ ਫੋਨ ਕਿਤੇ ਗਿਰਿਆ ਹੁੰਦਾ ਕੁਝ ਵੀ ਇੱਦਾਂ ਉਹਦੀ ਕੰਡੀਸ਼ਨ ਬੋਕਸ ਦੀ ਇੱਦਾਂ ਦੀ ਸੀਗੀ ਜਦੋਂ ਅਸੀਂ ਖੋਲ੍ਹ ਕੇ ਦੇਖਿਆ ਉਹਦੀ ਗਲਾਸ 'ਤੇ ਸਕਰੈਚ ਪਏ ਹੋਏ ਸੀ ਮਤਲਬ ਫੋਨ ਨੂੰ ਦੇਖ ਕੇ ਇੱਦਾਂ ਲੱਗਿਆ ਹੀ ਨਹੀਂ ਕਿ ਉਹ ਫੋਨ ਨਿਊ ਹੈ ਜਦੋਂ ਅਸੀਂ ਫੋਨ ਨੂੰ ਔਨ ਕੀਤਾ ਚਲਾ ਕੇ ਦੇਖਿਆ ਉਹਦੀ ਬੈਟਰੀ ਬੈਕਅਪ ਬੇਕਾਰ ਉਹਦੇ ਸਪੀਕਰਾਂ ਦੀ ਆਵਾਜ਼ ਬਿਲਕੁਲ ਨਹੀਂ ਅੱਛੀ ਮਤਲਬ ਅਸੀਂ ਕੈਸ਼ ਪੇਮੈਂਟ 'ਤੇ ਫੋਨ ਲਿਆ ਅਤੇ ਤੁਸੀਂ ਇੱਦਾਂ ਦਾ ਸਾਨੂੰ ਫੋਨ ਦਿੱਤਾ ਕਿ ਅਸੀਂ ਅੱਗੇ ਨੂੰ ਵੀ ਸੁਜੈਸਟ ਇਹੀ ਕਰਾਂਗੇ ਆਪਣੇ ਫਰੈਂਡਸ ਨੂੰ ਕਿ ਤੁਹਾਡੇ ਤੋਂ ਤੁਹਾਡੇ ਕੋਲ ਨਾ ਜਾਣ ਕਿਉਂਕਿ ਕੈਸ਼ ਪੇਮੈਂਟ ਅਤੇ ਤੁਸੀਂ ਆਹ ਕੁਛ ਸਾਡੇ ਨੂੰ ਸਾਨੂੰ ਭੇਜਿਆ ਫੋਨ ਫੋਨ ਦੇਖ ਕੇ ਮਨ ਬਹੁਤ ਦੁਖੀ ਹੋਇਆ ਜਾਂ ਤਾਂ ਸਾਡਾ ਫੋਨ ਚੇਂਜ ਕਰੋ ਜਾਂ ਸਾਡੀ ਜਿਹੜੀ ਪੇਮੈਂਟ ਆ ਉਹ ਤੁਸੀਂ ਵਾਪਸ ਕਰੋ ਥੈਂਕ ਯੂ